ਅਸੀਂ ਵਨ ਵਿਭਾਗ ਤੋਂ ਬੋਲਦੇ ਹਾਂ ਜੀ ਹਾਂਜੀ ਦੱਸੋ ਅੱਛਾ ਬਈ ਤੁਸੀਂ ਪੌਦੇ ਲੈਣੇ ਆ ਮਤਲਬ ਉੱਦਾਂ ਇਹ ਜਾਣਕਾਰੀ ਲੈਣੀ ਹੈ ਅੱਛਾ ਬਈ ਜਿਵੇਂ ਹੁਣ ਗਰਮੀਆਂ ਦੇ ਵਿੱਚ ਤਾਂ ਜਿਵੇਂ ਭਿੰਡੀ ਵੀ ਲਗਾ ਸਕਦੇ ਹੋ ਸਬਜ਼ੀਆਂ ਦੇ ਵਿੱਚ ਅਤੇ ਹੈਗੇ ਆ ਬਈ ਹਾਂ ਸਬਜ਼ੀਆਂ ਦੇ ਵਿੱਚ ਹੀ ਅਤੇ ਕੱਦੂ ਲਗਾ ਸਕਦੇ ਹੋ ਮਿਰਚ ਤਾਂ ਹੋ ਹੀ ਜਾਂਦੀ ਹੈਗੀ ਜਿਵੇਂ ਹਰ ਬਈ ਹੋ ਹੀ ਜਾਂਦੀ ਹੈ ਹਰੀ ਮਿਰਚ ਹਾਂ ਹਾਂ ਅਤੇ ਹੋਰ ਕਿਨਮ ਹੈਗੇ ਆ ਜਿਵੇਂ ਸਰਦੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਸਾਗ ਹੋ ਗਿਆ ਪਾਲਕ ਹੋ ਗਈ ਹਾਂ ਪਾਲਕ ਹੋ ਗਈ ਇੱਦਾਂ ਅਤੇ ਜੇ ਫਰੂਟ ਦਾ ਫਰੂਟ ਦਾ ਹੋਇਆ ਫਰੂਟ ਜਿਵੇਂ ਕਿਨਮ ਹੈਗੇ ਕੇਲਾ ਜਦੋਂ ਮਰਜ਼ੀ ਤੁਸੀਂ ਲਗਾ ਸਕਦੇ ਹੋ ਅਤੇ ਬਾਕੀ ਵੈਸੇ ਤੁਸੀਂ ਕਿਨਮ ਹੈਗੇ ਆ ਲਗਾਉਣੇ ਹੀ ਹੈ ਜਾਂ ਉੱਦਾਂ ਬਈ ਜਿਵੇਂ ਜੇ ਛਾਂ ਵਾਸਤੇ ਲੈਣੇ ਹੈ ਤਾਂ ਕੋਈ ਵੀ ਪੌ ਕਿਨਮ ਹੈਗਾ ਆ ਦਰਖ਼ਤ ਲਗਾ ਸਕਦੇ ਹੋ ਉਹ ਤਾਂ ਮਤਲਬ ਬਈ ਹਰ ਉਹ ਹਾਂ ਹਰ ਮੌਸਮ ਵਿਚ ਹੋ ਹੀ ਸਕਦਾ ਹੈ ਜਿਵੇਂ ਨਿੰਮ ਲਗਾ ਲਓ ਉਹਦੀ ਵੀ ਛਾਂ ਹੋ ਜਾਂਦੀ ਹੈ ਇੱਕ ਸੁਖਚੈਨ ਪੌਦਾ ਹੈ ਉਹਦਾ ਉਹ ਵੀ ਬਹੁਤ ਜ਼ਿਆਦਾ ਫੈਲਦਾ ਜਿਵੇਂ ਬਈ ਉਹ ਤੁਸੀਂ ਲਗਾ ਸਕਦੇ ਹੋ ਫਰੀ ਲਗਾ ਸਕਦੇ ਹੋ ਹਾਂਜੀ ਅਤੇ ਬਹੁ ਜਾਮਣ ਹਾਂ ਹਾਂ ਜਾਮਣ ਵੀ ਹੁੰਦੇ ਆ ਹਾਂਜੀ ਇਹ ਵੀ ਲਗਾ ਸਕਦੇ ਹੋ ਅਤੇ ਬਾਕੀ ਹੋਰ ਹਾਂ ਹਾਂ ਨਿੰਮ ਨਿੰਮ ਹੁੰਦੀ ਹੈ ਨਿੰਮ ਹੋ ਗਈ ਜਿਵੇਂ ਡੇਕ ਹੋ ਗਈ ਇੱਕ ਬਰਕੈਨ ਮਤਲਬ ਹੁੰਦੀਆਂ ਤਿੰਨੋਂ ਚੀਜ਼ਾਂ ਸੇਮ ਹੀ ਆ ਜਿੱਦਾਂ ਅਤੇ ਵੈਸੇ ਜ਼ਿਆਦਾ ਜਿਵੇਂ ਅਗਲੇ ਨਿੰਮ ਵਰਤਦੇ ਹੈਗੇ ਆ ਹੈ ਨਾ ਡੇਕ ਬਰਕੈਨ ਜਲਦੀ ਹੁੰਦੀਆਂ ਹੈਗੀਆਂ ਹੈ ਇਹਨਾਂ ਦੀ ਛਾਂ ਵੀ ਬਹੁਤ ਹੁੰਦੀ ਹੈ ਹਾਂ ਹਾਂ ਤੂਤ ਵੀ ਹਾਂ ਤੂਤ ਵੀ ਲਗਾ ਲੈ ਸਕਦੇ ਹੋ ਜਿਵੇਂ ਉਹ ਵੀ ਸਹੀ ਹੈ ਫਰੂਟ ਦੇ ਵਿੱਚ ਜਿਵੇਂ ਅੰਗੂਰ ਫਰੂਟਾਂ ਵਿੱਚ ਜਿਵੇਂ ਅੰਗੂਰ ਹੋ ਗਿਆ ਅੰਗੂਰ ਵੀ ਤੁਸੀਂ ਹਾਂ ਅੰਗੂਰ ਵੀ ਕਿਨਮ ਹੈਗੇ ਲਗਾ ਸਕਦੇ ਹੋ ਉਹਦੀ ਵੇਲ ਵੀ ਵਧੀਆ ਬਣਦੀ ਹੈ ਲੱਗਦੀ ਹੈ ਜਿਵੇਂ ਹਾਂ ਟਿੰਡੇ ਹੋ ਗਏ ਗਰਮੀ ਦੇ ਵਿੱਚ ਹਾਂਜੀ ਹਾਂ ਹਾਂ ਅਮਰੂਦ ਵੀ ਲਗਾ ਸਕਦੇ ਹੋ ਹਾਂ ਇਹ ਤਾਂ ਹੈਗੇ ਕਾਫੀ ਪੌਦੇ ਹੈਗੇ ਇਹਦੇ ਵਿੱਚ ਤਾਂ ਠੀਕ ਹੈ ਹੂੰ ਅਤੇ ਸਬਜ਼ੀਆਂ ਸਬਜ਼ੀਆਂ ਦੇ ਵਿੱਚ ਆਮ ਹੁਣ ਸਬਜ਼ੀ ਵੈਸੇ ਤਾਂ ਹੁਣ ਹਰ ਇੱਕ ਸੀਜਨ ਦੀ ਸਬਜ਼ੀ ਤਾਂ ਸਾਰੀ ਰਹਿਣ ਵੀ ਲੱਗ ਗਈ ਆ ਲੇਕਿਨ ਕਿਨਮ ਹੈਗੇ ਆ ਉਹ ਅਗਲੇ ਸਟੋਰ ਕਰਦੇ ਆ ਜਿਵੇਂ ਅਤੇ ਲਗਾਉਣ ਨੂੰ ਜਿਵੇਂ ਤਾਜ਼ੀ ਚਾਹੀਦੀ ਹੈਗੀ ਆਪਾਂ ਨੂੰ ਫਿਰ ਤਾਜ਼ੀ ਤਾਂ ਕਿਨਮ ਹੈਗੇ ਆ ਜਿਵੇਂ ਆਲੂ ਵੀ ਹੁੰਦੇ ਜਿਵੇਂ ਆਲੂ ਦੇਖ ਲਓ ਆਲੂ ਹੋਗੀ ਹਾਂ ਸਬਜ਼ੀ 'ਚ ਗੋਭੀ ਹੁੰਦੀ ਹੈ ਜਿਵੇਂ ਪੱਤਾ ਗੋਭੀ ਹੋ ਗਈ ਫੁੱਲ ਗੋਭੀ ਹੋ ਗਈ ਮਟਰ ਹੋ ਗਏ ਮਟਰ ਹੋ ਗਏ ਗਾਜਰ ਹੋ ਗਈ

ਹਾਂ ਚਲੋ ਠੀਕ ਹੈ ਜੀ ਓਕੇ ਠੀਕ